ਮੈਂ ਦੋ ਹਜ਼ਾਰ ਸੌਲ੍ਹਾਂ ਦੇ ਵਿੱਚ ਕੈਨੇਡਾ ਸਰੀ ਵਿੱਚ ਸ਼ਿਫਟ ਹੋ ਗਿਆ ਸੀਗਾ ਕਿਉਂਕਿ ਮੇਰੀ ਸਾਰੀ ਫੈਮਲੀ ਕੈਨੇਡਾ ਨੂੰ ਬਿਲੋਂਗ ਕਰਦੀ ਹੈ ਇੱਥੇ ਮੈਂ ਮੇਰੀ ਦਾਦੀ ਅਤੇ ਮੇਰੀ ਮਾਂ ਅਤੇ ਮੇਰਾ ਬੇਟਾ ਜਿਹੜਾ ਕਿ ਚਾਰ ਸਾਲ ਦਾ ਹੈ ਅਤੇ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਆਪਣੇ ਪੰਜਾਬ ਦਾ ਬੜਾ ਬਹੁਤ ਜ਼ਿਆਦਾ ਯਾਦ ਆਈ ਹੈ ਅਤੇ ਮੈਨੂੰ ਬੜਾ ਪੰਜਾਬ ਦੇ ਕਲਚਰ ਸੱਭਿਆਚਾਰਕ ਅਤੇ ਹੋਰ ਮੇਲ ਮਿਲਾਪ ਬੜੇ ਮੈਨੂੰ ਬੜੇ ਉੱਥੇ ਬਹੁਤ ਜ਼ਿਆਦਾ ਯਾਦ ਆਏ ਕਿਉਂਕਿ ਮੇਰੇ ਪਿਤਾ ਸਰਦਾਰ ਰੌਣਕ ਸਿੰਘ ਜੀ ਆਪਣੇ ਪੰਜਾਬ ਦੀਆਂ ਜੜ੍ਹਾਂ ਖੇਤੀਬਾੜੀ ਅਤੇ ਹੋਰ ਕਿੱਤਿਆਂ ਨਾਲ ਕਾਫੀ ਜੁੜੇ ਵੇ ਸੀਗੇ ਜਿਹੜੇ ਕਿ ਮੈਂ ਉੱਥੇ ਬਹੁਤ ਜ਼ਿਆਦਾ ਮਿਸ ਕਰਦਾ ਤਾ ਉਹ ਤੋਂ ਬਾਅਦ ਮੈਂ ਦੋ ਹਜ਼ਾਰ ਅਠਾਰ੍ਹਾਂ 'ਚ ਜਨਵਰੀ 'ਚ ਮੈਂ ਇੰਡੀਆ ਵਾਪਸ ਆਇਆ ਅਤੇ ਇੱਕ ਵਾਰ ਦਿਲ ਜ਼ਰੂਰ ਕਰਿਆ ਸੀਗਾ ਵੀ ਮੈਂ ਕਨੇਡਾ ਨੂੰ ਬਿਲਕੁਲ ਛੱਡ ਦੇਵਾਂ ਕਿਉਂਕਿ ਮੈਂ ਪੰਜਾਬ ਦੀਆਂ ਆਪਣੀ ਜਿਹੜੀਆਂ ਜੜ੍ਹਾਂ ਸੀ ਮੇਰਾ ਪਿੰਡ ਸੀ ਅਤੇ ਮੇਰਾ ਘਰ ਮੇਰੀ ਦਾਦੀ ਦੀਆਂ ਯਾਦਾਂ ਮੇਰੀ ਮਾਂ ਦੀਆਂ ਮੇਰੀਆਂ ਭੈਣਾਂ ਦੀਆਂ ਇੱਕ ਘਰ 'ਚ ਅਸੀਂ ਇਕੱਠੇ ਰਹਿੰਦੇ ਸੀਗੇ ਅਤੇ ਜ਼ਿਆਦਾਤਰ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਅਤੇ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਜੋ ਕਿ ਸਿੰਘ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅੱਠਵੇਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਤੇ ਤਰਨਾ ਦਲ ਦੇ ਸੱਤਵੇਂ ਜੱਥੇਦਾਰ ਸੀਗੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਮੇਰਾ ਆਉਣਾ ਜਾਣਾ ਸੀ ਉਹਨਾਂ ਦੇ ਸਿੱਖ ਉਹਨਾਂ ਦੇ ਰਿਲੇਟਡ ਮੈਂ ਬਹੁਤ ਕਿਤਾਬਾਂ ਪੜ੍ਹੀਆਂ ਅਤੇ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਮਿਲਣਾ ਸੀਗਾ ਜੀ ਇਸ ਕਰਕੇ ਮੈਂ ਕਨੇਡਾ ਛੱਡ ਕੇ ਪੰਜਾਬ 'ਚ ਇਸ ਟਾਈਮ ਰਹਿ ਰਿਹਾ ਮੈਂ ਆਪਣੀਆਂ ਜੜ੍ਹਾਂ ਨੂੰ ਯਾਦ ਕਰਦਾ ਮਹਿਸੂਸ ਕਰਦਾ